ਤਰਨ ਤਾਰਨ ਜ਼ਿਲ੍ਹੇ ਵਿੱਚ ਮੁੱਖ ਉਦਯੋਗ ਜਿਵੇਂ ਕਿ ਖੰਡ ਦੀ ਮਿੱਲ ਪੇਪਰ ਮਿੱਲ ਕੱਪੜੇ ਦੀ ਫੈਕਟਰੀ ਪੱਖੇ ਕੂਲਰ ਫਰਿੱਜ ਗੀਜਰ ਏ ਸੀ ਬਣਾਉਣ ਦੀਆਂ ਫੈਕਟਰੀਆਂ ਮੌਜੂਦ ਹਨ ਖੇਤੀਬਾੜੀ ਦੇ ਖੇਤਰ 'ਚ ਕੰਬਾਈਨ ਕੰਬਾਈਨ ਹੋ ਗਈ ਅਤੇ ਕੰਬਾਈਨ ਟਰੈਕਟਰ ਟਰਾਲੀ ਇਸ ਤਰ੍ਹਾਂ ਦੇ ਮੁੱਖ ਉਦਯੋਗ ਸ ਸਨ ਲੇਡੀ ਸੂਟ ਫੈਕਟਰੀ ਕਢਾਈ ਵਾਲੀਆਂ ਮਸ਼ੀਨਾਂ ਪੇਂਟਿੰਗ ਵਾਲੀਆਂ ਮਸ਼ੀਨਾਂ ਇਨ ਇੱਦਾਂ ਦੇ ਰੋਜ਼ ਫੈਕਟਰੀਆਂ ਨੇ ਇਹਨਾਂ ਤੋਂ ਸਾਨੂੰ ਰੋਜ਼ਗਾਰ ਮਿਲਦਾ ਹੈ ਅਤੇ ਇਹ ਸਾਡੇ ਮੁੱਖ ਸਾਧਨ ਹਨ ਅਤੇ